ਮੇਰੇ ਕਿਸੇ ਦੋਸਤ ਦਾ ਅਕਾਊਂਟ ਤਾਂ ਹੈਕ ਨਹੀਂ ਹੋਇਆ ਹੈ ਜੀ ਤਾਂ ਪਰ ਉਵੇਂ ਆਉਣ ਦੀਆਂ ਖਬਰਾਂ 'ਚ ਸਾਨੂੰ ਪਤਾ ਲੱਗਦਾ ਹੀ ਹੈ ਕਿ ਅੱਗੇ ਕਿਸੇ ਕਿਸੇ ਨਾ ਕਿਸੇ ਜਾਣ ਪਛਾਣ ਵਜੋਂ ਕੋਈ ਖਬਰ ਆ ਹੀ ਜਾਂਦੀ ਕਿ ਉਹਦਾ ਅਕਾਊਂਟ ਹੈਕ ਹੋ ਗਿਆ ਹੈ ਕੋਈ ਇਹ ਕੁਛ ਕੋਈ ਵੀ ਹੋ ਸਕਦਾ ਜਿਹਦਾ ਕਿਸੇ ਦਾ ਵੀ ਅਕਾਊਂਟ ਹੈਕ ਹੋ ਸਕਦਾ ਅਤੇ ਸੋਸ਼ਲ ਮੀਡੀਆ ਐਪਾਂ 'ਤੇ ਹੀ ਕਾਫੀ ਜਾਗਰੂਕਤਾ ਭਰੀਆਂ ਵੀਡੀਓ ਹਨ ਜਿਹਨਾਂ 'ਤੇ ਆਪਾਂ ਸਿੱਖ ਸਕਦੇ ਹਾਂ ਕਿ ਅਕਾਊਂਟ ਹੈਕ ਹੋ ਜਾਂਦਾ ਹੈ ਕਿਸੇ ਦਾ ਅਤੇ ਫਿਰ ਉਹ ਦੂਸਰੇ ਬੰਦੇ ਤੋਂ ਜਾ ਕੇ ਉਹਦੇ ਵੱਲੋਂ ਦੀ ਵੀ ਮੈਂ ਜ਼ਰੂਰਤ ਵਿੱਚ ਹਾਂ ਅਤੇ ਪੈਸੇ ਚਾਹੀਦੇ ਹਨ ਅਤੇ ਆਪਣੇ ਅਕਾਊਂਟ ਦੇ ਵਿੱਚ ਹੋਰ ਪਈਆਂ ਹੋਈਆਂ ਚੀਜ਼ਾਂ ਆਪਣੀ ਡਾਟਾ ਨੂੰ ਵੀ ਚੋਰੀ ਕਰ ਸਕਦੇ ਹਨ ਅਤੇ ਉਹਨਾਂ ਨੂੰ ਆਪਣੇ ਖਿਲਾਫ ਵਰਤ ਸਕਦੇ ਹਨ ਅਤੇ ਇਹ ਗੱਲਾਂ ਦਾ ਆਪਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣਾ ਪਾਸਵਰਡ ਪੱਕਾ ਹੋਵੇ ਅਤੇ ਹੋਰ ਇਸ ਤੋਂ ਬਾਅਦ ਅਗਰ ਹੈਕ ਹੋ ਵੀ ਜਾਏ ਤਾਂ ਉਹ ਨੂੰ ਉਹਦੀ ਰਿਪੋਰਟ ਕੀਤੀ ਜਾਵੇ ਅਤੇ ਆਪਣੇ ਈਮੇਲ ਆਈਡੀ ਜ਼ਰੂਰ ਚੈੱਕ ਕੀਤੀ ਕਿਉਂਕਿ ਹੈਕ ਹੋਣ ਤੋਂ ਬਾਅਦ ਰਜਿਸਟਰੇਸ਼ਨ ਦਾ ਇੱਕ ਨੋਟੀਫਿਕੇਸ਼ਨ ਜ਼ਰੂਰ ਆਉਂਦਾ ਆਪਣੇ ਕੋਲ ਵੀ ਅਤੇ ਫਿਰ ਉਹ ਈਮੇਲ ਜੇ ਆਪਾਂ ਚੈਕ ਕਰਦੇ ਰਹੀਏ ਅਤੇ ਉਸ ਤੋਂ ਬਾਅਦ ਆਪਾਂ ਉਹ ਬੰਦ ਵੀ ਕਰਾ ਸਕਦੇ ਹਾਂ ਉਹ ਐਪ ਚੱਲਣਾ ਵੀ